ਪੇਂਡੂ ਖੇਤਰਾਂ ਵਿੱਚ ਕਿਸਾਨਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੌਸਮ ਦੀ ਤਬਦੀਲੀ ਇੱਕ ਸਭ ਤੋਂ ਵੱਡੀ ਚੁਣੌਤੀ ਕਿਸਾਨਾਂ ਲਈ ਮੰਨੀ ਜਾ ਸਕਦੀ ਹੈ

ਸਭ ਤੋਂ ਵੱਡੀ ਮੌਸਮ ਦੀ ਤਬਦੀਲੀ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਇਸਨੂੰ ਇੱਕ ਕੁਦਰਤ ਦੀ ਆਫ਼ਤ ਵੀ ਕਿਹਾ ਜਾ ਜਾ ਸਕਦਾ ਹੈ ਕਿਉਂਕਿ ਜਦੋਂ ਫਸਲ ਬੂਰ 'ਤੇ ਜਾਂ ਫ਼ਲ 'ਤੇ ਆਈ ਹੁੰਦੀ ਹੈ ਅਤੇ ਮੌਸਮ ਦਾ ਬਦਲ ਕੇ ਅਤੇ ਤੇਜ਼ ਮੀਂਹ ਹਨੇਰੀ ਝੱਖੜਾਂ ਦਾ ਸਾਹਮਣਾ ਉਸ ਫਸਲ ਨੂੰ ਕਰਨਾ ਪੈਂਦਾ ਹੈ ਤਾਂ ਉਸਦਾ ਬਰਬਾਦ ਹੋਣਾ ਸੁਭਾਵਿਕ ਹੈ ਅਤੇ ਇਸ ਦਾ ਕੋਈ ਇਲਾਜ ਜਾਂ ਰੋਕਥਾਮ ਨਹੀਂ ਹੈ ਜਿਸ ਦਾ ਬਹੁਤ ਵੱਡਾ ਘਾਟਾ ਕਿਸਾਨ ਨੂੰ ਪੈਂਦਾ ਹੈ ਅਤੇ ਉਹ ਇਸ ਉਸਨੂੰ ਇਸ ਨਾਲ ਜੂਝਣਾ ਪੈਂਦਾ ਹੈ